ਵਿਦੇਸ਼ਾਂ ਵਿੱਚ ਜਿਸ ਤਰ੍ਹਾਂ ਕਿ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਨੌਜਵਾਨ ਆ ਜੋ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣਾ ਮੁਲਕ ਛੱਡ ਕੇ ਪਰਾਏ ਮੁਲਕ ਦੇ ਵਿੱਚ ਮਜ਼ਦੂਰੀ ਕਰਨ ਲਈ ਤਿਆਰ ਹਨ ਪ੍ਰੰਤੂ ਲੇਕਿਨ ਆਪਣੇ ਦੇਸ਼ ਦੇ ਵਿੱਚ ਉਹ ਕੰਮ ਕਰਨ ਲਈ ਨਹੀਂ ਤਿਆਰ ਹਨ ਸੋ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੀ ਹੈ ਕਿ ਓ ਉਹ ਇਸ ਮਨੋਰਥ ਨੂੰ ਲੈ ਕੇ ਜਾਂਦੇ ਹਨ ਕਿ ਉੱਥੇ ਜਾ ਕੇ ਅਸੀਂ ਬਹੁਤ ਜ਼ਿਆਦਾ ਕਮਾਈ ਕਰਾਂਗੇ ਔਰ ਕਮਾਈ ਕਰਕੇ ਅਸੀਂ ਉੱਥੇ ਸੈਟਲ ਹੋਵਾਂਗੇ ਔਰ ਜਿਹੜੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬੱਚੇ ਨੇ ਉਹ ਉੱਥੇ ਹੀ ਮਤਲਬ ਕਿ ਕੋਈ ਪੜ੍ਹਾਈ ਵਗੈਰਾ ਸਟਡੀ ਵਗੈਰਾ ਕਰਨਗੇ ਉੱਥੇ ਹੀ ਸੈਟਲ ਹੋਣਗੇ ਅਤੇ ਮੇਨ ਬਸ ਉਹਨਾਂ ਦਾ ਆਰਥਿਕ ਪੱਖੋਂ ਮਤਲਬ ਕਿ ਇੱਕ ਆਰਥਿਕ ਪੱਖੋਂ ਤਕੜੇ ਹੋਣ ਦਾ ਯਤਨ ਹੈ ਉੱਥੇ ਰਹਿਣਾ ਜਾਂ ਸੈਟਲ ਹੋਣ ਬਾਰੇ ਸੋਚਣਾ ਇਹ ਸਾਰਾ ਆਰਥਿਕ ਪ ਪੱਖੋਂ ਤਕੜੇ ਹੋਣ ਦਾ ਇੱਕ ਉਹਨਾਂ ਦਾ ਇਹ ਕਹਿ ਸਕਦੇ ਆਪਾਂ ਆ ਵੀ ਯਤਨ ਹੈ ਔਰ ਆਪਣੀ ਪੰਜਾਬ ਦੀ ਆਪਣੇ ਦੇਸ਼ ਦੀ ਧਰਤੀ ਨੂੰ ਛੱਡ ਕੇ ਉੱਥੇ ਜਾ ਰਹੇ ਨੇ ਅਤੇ ਇਸ ਨਾਲ ਪੰਜਾਬ 'ਤੇ ਇੱਕ ਇਹ ਅਸਰ ਪੈਂਦਾ ਹੈ ਕਿ ਪੰਜਾਬ ਇੱਕ ਇਸ ਤਰ੍ਹਾਂ ਇੱਕ ਖਾਲੀ ਖਾਲੀ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਕਿ ਬਹੁਤ ਸ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਅ ਕਨੇਡਾ ਅਮੈਰੀਕਾ ਇੰਗਲੈਂਡ ਵਗੈਰਾ ਕੰਟਰੀਜ ਦੇ ਵਿੱਚ ਸੈਟਲ ਹਨ ਔਰ ਵੱਡੀ ਗਿਣਤੀ ਦੇ ਵਿੱਚ ਅੱਜ ਕੱਲ੍ਹ ਉਹ ਸੈਟਲ ਹੋ ਰਹੇ ਨੇ ਅ ਹਰ ਨੌਜਵਾਨ ਹੈ ਜੋ ਉਹ ਪਲੱਸ ਟੂ ਤੋਂ ਬਾਅਦ ਹੀ ਅ ਆਈਲੈਟਸ ਕਰਕੇ ਅ ਕਨੇਡਾ ਅਮੈਰੀਕਾ ਜਾਂ ਯੂ ਅ ਯੂ ਐਸ ਇੰਗਲੈਂਡ ਵਰਗੀ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਹੈ ਜਿਸ ਕਰਕੇ ਕੋਈ ਮਤਲਬ ਕਿ ਪੰਜਾਬ ਦੇ ਨੌਜਵਾਨਾਂ 'ਚੋਂ ਅੱਗੇ ਪੜ੍ਹਨਾ ਵੀ ਨਹੀਂ ਚਾਹੁੰਦਾ ਔਰ ਪੰਜਾਬ ਦੇ ਸਕੂਲ ਕਾਲਜਾਂ ਦੇ ਵਿੱਚ ਅਦਰ ਸਟੇਟ ਦੇ ਬੱਚੇ ਆ ਕੇ ਸਗੋਂ ਪੜ੍ਹਾਈ ਕਰ ਰਹੇ ਹਨ ਪਰੰਤੂ ਪੰਜਾਬ ਦੇ ਬੱਚੇ ਬਹੁਤ ਘੱਟ ਰਹਿੰਦੇ ਪੜ੍ਹਾਈ ਕਰਦੇ ਦਿਖਦੇ ਹਨ ਐਂਡ ਪੰਜਾਬ ਪੰਜਾਬ ਦੇ ਪਿੰਡ ਵੀ ਕਈ ਮਤਲਬ ਕ ਖਾਲੀ ਹੋ ਰਹੇ ਨੇ ਸ਼ਹਿਰ ਵੀ ਖਾਲੀ ਹੋ ਰਹੇ ਨੇ ਜਿੱਥੇ ਕਿ ਪੰਜਾਬੀਆਂ ਦਾ ਵਾਸਾ ਨਹੀਂ ਹੈ